ਸਤਿ ਸ਼੍ਰੀ ਅਕਾਲ ਸਰ ਦੇਸ਼ ਰਾਜ ਮੈਂ ਬੋਲਦਾ ਪਿੰਡ ਭੂਰਚੱਕ ਢੇਸੀਆਂ ਰਹਿਣ ਵਾਲਾ ਪਠਾਨਕੋਟ ਦਾ ਹਾਂ ਸਰ ਮੈਂ ਇੱਕ ਨਿਊਜ਼ ਪੜ੍ਹੀ ਸੀ ਅਖਬਾਰ ਦੇ ਵਿੱਚ ਤੁਹਾਡੀ ਬਾਰੇ ਇੱਕ ਚਾਦਰ ਮੰਗਵਾਈ ਸੀ ਉਹ ਚਾਦਰ ਪੰਜ ਸੌ ਰੁਪਏ ਦੀ ਸੀ ਉਹ ਚਾਦਰ ਤੁਹਾਡੇ ਕੋਲੋਂ ਦੋ ਦਿਨ ਪਹਿਲੇ ਮੰਗਵਾਈ ਹੋਈ ਚਾਦਰ ਦੋ ਤਿੰਨ ਦਿਨ ਦੇ ਬਾਅਦ ਆਈ ਸੀ ਉਸ ਚਾਦਰ ਨੂੰ ਫੋਨ ਦੇ ਵਿੱਚ ਉਸ ਚਾਦਰ ਦਾ ਰੰਗ ਬਹੁਤ ਪਸੰਦ ਲੱਗਾ ਸੀ ਉਹ ਚਾਦਰ ਜਦੋਂ ਅਸੀਂ ਖੋਲ੍ਹ ਕੇ ਦੇਖੀ ਚਾਦਰ ਦੇ ਨਾਲ ਇੱਕ ਸਿਰਹਾਣਾ ਅਤੇ ਇੱਕ ਗਿਲਾਫ ਹੁੰਦਾ ਸੀ ਉਹ ਚਾਦਰ ਬਿਲਕੁਲ ਹੀ ਸਿੰਗਲ ਸੀ ਉਸ ਚਾਦਰ ਜਦੋਂ ਅਸੀਂ ਧੋਤੀ ਸੀ ਉਸ ਚਾਦਰ ਦਾ ਰੰਗ ਬਿਲਕੁਲ ਹੀ ਫੇਂਟ ਹੋ ਚੁੱਕਾ ਸੀ ਅਸੀਂ ਤੁਹਾਨੂੰ ਪੰਜ ਸੌ ਰੁਪਈਆ ਚਾਦਰ ਦਾ ਦੇ ਦਿੱਤਾ ਸੀ ਅਸੀਂ ਤੁਹਾਡੇ ਕੋਲੋਂ ਪੈਸੇ ਵਾਪਸ ਲੈਣਾ ਚਾਹੁੰਦੇ ਹਾਂ ਤੁਸੀਂ ਆਪਣੀ ਚਾਦਰ ਵਾਪਸ ਲੈ ਸਕਦੇ ਹੋ ਸਾਨੂੰ ਆਪਣੀ ਚਾਦਰ ਨਹੀਂ ਤਾਂ ਵਾਪਸ ਲੈ ਜਾਓ ਸਾਡੇ ਪੈਸੇ ਵਾਪਸ ਕਰ ਦੇਵੋ